ਸਤਿ ਸ਼੍ਰੀ ਅਕਾਲ ਅੱਛਾ ਕਿਹੜੇ ਡਿਪਾਰਟਮੈਂਟ 'ਚ ਹੋ ਤੁਸੀਂ ਅੱਛਾ ਠੀਕ ਹੈ ਤੁਸੀਂ ਉਹ ਹੀ ਹੋ ਜਿਹਦੀ ਹਫ਼ਤੇ ਕੁ ਪਹਿਲਾਂ ਸਰਜਰੀ ਹੋਈ ਸੀ ਠੀਕ ਹੈ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵੀ ਤੁਸੀਂ ਮਤਲਬ ਕੀ ਕੁਛ ਨਾ ਖਾਓ ਤੁਸੀਂ ਇੱਕ ਤਾਂ ਮਤਲਬ ਕਿ ਬਾਹਲਾ ਗਰਮ ਸਮਾਨ ਨਹੀਂ ਖਾਣਾ ਹੈਗਾ ਅਤੇ ਨਾ ਹੀ ਮਤਲਬ ਕਿ ਤਲੀਆਂ ਚੀਜ਼ਾਂ ਖਾਣੀਆਂ ਜਿਵੇਂ ਕਿ ਕੋਈ ਜਿਹਦੇ 'ਚ ਜ਼ਿਆਦਾ ਤੇਲ ਵਗੈਰਾ ਪਾਇਆ ਜਾਵੇ ਉਵੇਂ ਦੀਆਂ ਚੀਜ਼ਾਂ ਨਹੀਂ ਖਾਣੀਆਂ ਨਾ ਹੀ ਤੁਸੀਂ ਜ਼ਿਆਦਾ ਕੁਛ ਖੱਟਾ ਖਾਣਾ ਹੈਗਾ ਠੀਕ ਹੈ ਨਹੀਂ ਤਾਂ ਤੁਹਾਡੇ ਜਿਹੜੇ ਟਾਂਕਿਆਂ 'ਤੇ ਅਸਰ ਪਵੇਗਾ ਇਹਨਾਂ ਚੀਜ਼ਾਂ ਦਾ ਤਾਂ ਤੁਸੀਂ ਖਾਣੇ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣਾ ਠੀਕ ਹੈ ਹਾਂਜੀ ਹਾਂਜੀ ਦੁੱਧ ਤਾਂ ਤੁਸੀਂ ਲੈ ਸਕਦੇ ਹੋਂ ਪਰ ਤੁਸੀਂ ਇਹ ਧਿਆਨ ਰੱਖਣਾ ਵੀ ਦੁੱਧ ਬਾਹਲਾ ਗਰਮ ਵੀ ਨਾ ਹੋਵੇ ਅਤੇ ਠੰਡਾ ਤਾਂ ਬਿਲਕੁਲ ਹੀ ਨਹੀਂ ਲੈਣਾ ਹੈਗਾ ਤੁਸੀਂ ਕੋਸਾ ਜਿਹਾ ਕਰ ਲਿਉ ਦੁੱਧ ਨੂੰ ਫਿਰ ਤੁਸੀਂ ਲੈ ਸਕਦੇ ਓਂ ਠੀਕ ਹੈ ਹਾਂਜੀ ਦਹੀਂ ਲੱਸੀ ਤਾਂ ਮੈਂ ਤਾਂ ਤੁਹਾਨੂੰ ਇਹ ਹੀ ਕਹਾਂਗੀ ਕਿ ਤੁਸੀਂ ਦਹੀਂ ਲੱਸੀ ਨਾ ਹੀ ਲਉ ਕਿਉਂਕਿ ਉਹ ਖੱਟਾ ਹੁੰਦਾ ਹੈ ਤਾਂ ਕੀ ਪਤਾ ਤੁਹਾਡੇ ਮਤਲਬ ਕੀ ਸਿਹਤ 'ਤੇ ਬਹੁਤ ਗਲਤ ਅਸਰ ਪਵੇਗਾ ਤਾਂ ਤੁਸੀਂ ਜ਼ਿਆਦਾਤਰ ਹੋ ਸਕੇ ਤਾਂ ਤੁਸੀਂ ਜੂਸ ਪੀਓ ਪਾਣੀ ਪੀਓ ਵੱਧ ਤੋਂ ਵੱਧ ਫਲ ਵਗੈਰਾ ਲੈ ਸਕਦੇ ਓਂ ਤੁਸੀਂ ਠੀਕ ਹੈ ਹਾਂਜੀ ਅਤੇ ਇਹ ਤਾਂ ਮੈਂ ਡਾਕਟਰ ਤੋਂ ਪੁੱਛ ਲਵਾਂਗੀ ਤੁਸੀਂ ਮੈਂ ਤੁਹਾਨੂੰ ਪੁੱਛ ਕੇ ਦੱਸ ਦਵਾਂਗੀ ਵੀ ਕਦੋਂ ਤੁਸੀਂ ਆ ਜਾਉ ਬਾਕੀ ਤੁਸੀਂ ਵੈਸੇ ਹਫ਼ਤੇ ਕੁ ਬਾਅਦ ਆ ਜਾਇਆ ਕਰੋ ਚੈੱਕਅਪ ਕਰਵਾਉਣ ਲਈ ਇੱਕ ਤੁਸੀਂ ਧਿਆਨ ਰੱਖਣਾ ਹੈ ਵੀ ਤੁਸੀਂ ਬਾਹਲਾ ਮਤਲਬ ਕਿ ਭਾਰਾ ਸਮਾਨ ਨਾ ਚੁੱਕੋ ਕੋਈ ਜ਼ਿਆਦਾ ਕੰਮ ਨਾ ਕਰੋ ਵੀ ਤਾਂ ਕਿ ਤੁਹਾਡੇ ਟਾਂਕਿਆਂ 'ਤੇ ਅਸਰ ਨਾ ਪਵੇ ਕੋਈ ਜ਼ਿਆਦਾ ਭੱਜ ਦੌੜ ਵਾਲਾ ਕੰਮ ਨਹੀਂ ਕਰਨਾ ਨਹੀਂ ਤਾਂ ਤੁਹਾਡੇ ਟਾਂਕੇ ਖੁੱਲ੍ਹਣ ਦਾ ਵੀ ਡਰ ਹੋ ਸਕਦਾ ਹਾਂਜੀ ਬਾਕੀ ਭੋਜਨ ਸਾਦਾ ਭੋਜਨ ਹੀ ਖਾਓ ਜਿਵੇਂ ਦਾਲ ਰੋਟੀ ਜ਼ਿਆਦਾ ਤੜਕਾ ਨਾ ਲਗਾਓ ਤੇਲ ਵਗੈਰਾ ਬਹੁਤ ਘੱਟ ਪਾਉਣਾ ਤੁਸੀਂ ਖਾਣੇ 'ਚ ਤਾਂ ਕਿ ਉਹ ਆਇਲ ਜਿਹੜਾ ਹੈਗਾ ਤੁਹਾਡੇ ਸਿਹਤ 'ਤੇ ਜ਼ਿਆਦਾ ਅਸਰ ਨਾ ਕਰੇ ਹਾਂਜੀ ਹਾਂਜੀ ਜੇ ਤਾਂ ਤੁਹਾਨੂੰ ਹਾਂਜੀ ਪ੍ਰਹੇਜ ਬਸ ਇੰਨਾ ਵੀ ਬਾਹਰ ਦਾ ਖਾਣਾ ਤਾਂ ਤੁਸੀਂ ਬਿਲਕੁਲ ਹੀ ਨਾ ਖਾਇਓ ਠੀਕ ਹੈ ਹੋ ਸਕੇ ਤਾਂ ਘਰ ਹੀ ਆਪਣਾ ਮਤਲਬ ਕਿ ਵਧੀਆ ਤਰੀਕੇ ਨਾਲ ਸ਼ੁੱਧ ਸਾਫ਼ ਭੋਜਨ ਬਣਾਓ ਤਾਂ ਕਿ ਤੁਹਾਨੂੰ ਆਪਣੇ ਮਤਲਬ ਕਿ ਕੋਈ ਇਨਫੈਕਸ਼ਨ ਨਾ ਹੋ ਜਾਵੇ ਤੁਹਾਡੇ ਅੰਦਰ ਤਾਂ ਕਰਕੇ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ